ਮੈਂ ਗੁਰਚਰਨ ਸਿੰਘ ਨੂਰਪੁਰਬੇਦੀ ਪੰਜਾਬ ਤਹਿਸੀਲ ਅਨੰਦਪੁਰ ਸਾਹਿਬ ਮੈਂ ਪਸ਼ੂਆਂ ਦੇ ਦੇ ਵਿੱਚ ਪਸ਼ੂਆਂ ਦੇ ਜਿਹੜਾ ਕੰਮ ਕਾਰੋਬਾਰ ਕਰਦਾ ਹਾਂ ਅਤੇ ਉਹਨਾਂ ਦੇ ਵਿੱਚ ਜਿਹੜਾ ਪਸ਼ੂ ਹੈ ਅਸੀਂ ਲੈ ਕੇ ਆਉਂਦੇ ਹੈ ਜਾਂ ਉਹ ਗਾਏ ਗਊ ਹੈ ਜਾਂ ਮੱਝ ਹੈ ਅਸੀਂ ਉਹਨੂੰ ਲਿਆ ਕੇ ਘਰ ਦੇ ਵਿੱਚ ਪਹਿਲਾਂ ਉਹਨਾਂ ਵਾਸਤੇ ਪ੍ਰਬੰਧ ਕਰਦੇ ਹਾਂ ਵੀ ਸ਼ੈਡ ਬਣਾਇਆ ਜਾਂਦਾ ਹੈ ਟੀਨ ਪਾਈ ਜਾਂਦੀ ਹੈ ਔਰ ਉਹਨਾਂ ਦੇ ਵਾਸਤੇ ਅੰਦਰ ਜਿਹੜੇ ਹੈ ਬੰਨਣ ਦਾ ਪ੍ਰਬੰਧ ਅਤੇ ਦੂਸਰਾ ਖੁਰਲੀਆਂ ਉਹਦੇ ਪੱਠਿਆਂ ਵਾਸਤੇ ਪ੍ਰਬੰਧ ਅਤੇ ਦੂਸਰਾ ਅਗਲਾ ਪ੍ਰੋਗਰਾਮ ਜਿਹੜਾ ਹੈ ਉਹ ਪਾਣੀ ਦਾ ਵੀ ਪ੍ਰਬੰਧ ਉਹਨਾਂ ਵਾਸਤੇ ਸਪੈਸ਼ਲ ਕੀਤਾ ਜਾਂਦਾ ਆ ਅਤੇ ਕਈ ਵਾਰ ਅਸੀਂ ਲਾਗੜ ਜਿਹੜੇ ਹੈ ਉਹ ਮੱਝਾਂ ਲੈ ਕੇ ਆਉਂਦੇ ਉਹਨਾਂ ਦੇ ਵੀ ਜਿਹੜੇ ਬੱਚੇ ਹੈ ਉਹਨਾਂ ਨੂੰ ਪਾਲਣਾ ਬਹੁਤ ਹੀ ਢੰਗ ਤਰੀਕੇ ਦੇ ਨਾਲ ਹੁੰਦਾ ਹੈ ਕਿਉਂਕਿ ਉਹਨਾਂ ਦੀ ਜਿਹੜੀ ਖੁਰਾਕ ਜਿਹੜਾ ਦੁੱਧ ਹੈ ਉਹਨਾਂ ਨੂੰ ਉਹ ਆਪਾਂ ਮੱਝ ਚੋਣ ਤੋਂ ਪਹਿਲਾਂ ਦਿੰਦੇ ਹਾਂ ਔਰ ਉਹਦੇ ਦੋ ਥਣ ਜਿਹੜੇ ਆ ਮੱਝ ਉਹਦੇ ਵਾਸਤੇ ਕੱਟਾ ਹੋਵੇ ਜਾਂ ਕੱਟੀ ਹੋਵੇ ਉਹਦੇ ਵਾਸਤੇ ਰੱਖੇ ਜਾਂਦੇ ਹੈ ਔਰ ਉਹਨਾਂ ਨੂੰ ਦੁੱਧ ਪਿਲਾ ਕੇ ਫਿਰ ਅਸੀਂ ਮੱਝ ਚੌਂਦੇ ਹਾਂ ਤਾਂ ਥਣ ਧੋਂਦੇ ਹੈ ਅਤੇ ਥਣਾਂ ਨੂੰ ਧੋ ਕੇ ਜਿਹੜਾ ਆ ਚਵਾਈ ਕਰਦੇ ਹਾਂ ਚਵਾਈ ਕਰਨ ਤੋਂ ਬਾਅਦ ਫਿਰ ਅਸੀਂ ਇੱਕ ਵਾਰ ਜਿਹੜਾ ਬੱਚੇ ਨੂੰ ਛੱਡਦੇ ਹਾਂ ਅਤੇ ਉਹ ਵੀ ਪਰ ਫਿਰ ਥੋੜ੍ਹਾ ਚੁੰਘਦਾ ਹੈ ਅਤੇ ਉਸ ਤੋਂ ਬਾਅਦ ਪੂਰੀ ਪੰਜ ਛੇ ਮਹੀਨੇ ਪੂਰੀ ਦੇਖ ਰੇਖ ਕੀਤੀ ਜਾਂਦੀ ਹੈ ਜਦੋਂ ਪੰਜ ਛੇ ਮਹੀਨੇ ਸੱਤ ਦਾ ਹੋ ਗਿਆ ਉਸ ਤਾਂ ਫਿਰ ਉਹਨੂੰ ਅਸੀਂ ਹਟਾ ਦਿੰਦੇ ਹੈ ਕਿਉਂਕਿ ਉਸਦੇ ਦੰਦ ਜਿਹੜੇ ਵੱਡੇ ਹੋ ਜਾਂਦੇ ਅਤੇ ਜਿਹੜੇ ਫਿਰ ਉਹ ਮੱਝ ਦੇ ਗਾਵਾਂ ਦੇ ਥਣਾਂ ਨੂੰ ਕੱਟਣ ਲੱਗ ਪੈਂਦੇ ਹੈ ਜ਼ਖ਼ਮ ਹੋ ਜਾਂਦੇ ਹੈ ਇਸ ਕਰਕੇ ਜਿਹੜਾ ਹੈ ਉਹਦੀ ਮੱਝ ਦਾ ਵੀ ਖਿਆਲ ਰੱਖਿਆ ਜਾਂਦਾ ਅਤੇ ਬੱਚੇ ਦਾ ਵੀ ਖਿਆਲ ਰੱਖਿਆ ਜਾਂਦਾ ਅਤੇ ਬੱਚਿਆਂ ਜਿਹੜਾ ਹੈ ਉਹ ਸਾਲ ਕੁ ਤੋਂ ਬਾਅਦ ਆਪ ਜਿਹੜਾ ਹੈ ਚੰਗਾ ਖੁਰਾਕ ਖਾਣੀ ਸ਼ੁਰੂ ਕਰ ਦਿੰਦਾ ਹੈ ਔਰ ਉਸ ਤੋਂ ਬਾਅਦ ਉਹ ਦੋ ਢਾਈ ਸਾਲ ਦਾ ਹੋ ਕੇ ਜਿਹੜਾ ਵੱਡਾ ਬੱਚਾ ਹੈ ਅਤੇ ਢਾਈ ਸਾਲ ਦਾ ਉਹ ਜਿਹੜਾ ਬੱਚਾ ਆਪਣਾ ਬਣ ਜਾਂਦਾ ਹੈ ਹੁਣ ਦੁਬਾਰੇ ਲ ਲਗ